ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬੀ ਬਹੁਤ ਹੀ ਜ਼ਿਆਦਾ ਮਸ਼ਹੂਰ ਤਾਂ ਨਹੀਂ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਪੰਜਾਬੀ ਹੌਲੀ ਹੌਲੀ ਹਰ ਖੇਤਰ 'ਚ ਪੂਰੇ ਦੁਨੀਆ 'ਤੇ ਪਹੁੰਚ ਗਈ ਹੈ ਜਿਵੇਂ ਜਿਵੇਂ ਆਪਣੀ ਤਕਨੀਕੀ ਵਿਕਾਸ ਹੋਇਆ ਜਿੱਦਾਂ ਅਖਬਾਰਾਂ ਦਾ ਪ੍ਰਚਲਨ ਚੱਲਿਆ ਆਪਣੇ ਟੀ ਵੀ ਚੈਨਲ ਚੱਲੇ ਸੋਸ਼ਲ ਮੀਡੀਆ ਦਾ ਜਿਹੜਾ ਹੈ ਪ੍ਰਚਲਨ ਚੱਲਿਆ ਉਹਦੇ ਕਰਕੇ ਜਿਹੜੀ ਪੰਜਾਬੀ ਸੀ ਉਹ ਦੁਨੀਆਂ 'ਤੇ ਹਰ ਇੱਕ ਖੇਤਰ 'ਤੇ ਪਹੁੰਚ ਗਈ ਹੈ ਅੱਜ ਕੱਲ ਦੇਖਿਆ ਜਾਵੇ ਤਾਂ ਪੰਜਾਬੀ ਜਿਹੜੀ ਹੈ ਆਪਣੇ ਭਾਰਤ ਦੇ ਹਰ ਇੱਕ ਕੋਨੇ 'ਚ ਤੁਹਾਨੂੰ ਕਿਤੇ ਨਾ ਕਿਤੇ ਤਾਂ ਮਿਲ ਹੀ ਜਾਏਗਾ ਅਤੇ ਜੇ ਤੁਸੀਂ ਦੁਨੀਆਂ ਦੇ ਦੂਸਰੇ ਕੋਨੇ 'ਤੇ ਵੀ ਜਾਂਦੇ ਹੋ ਕਿਸੇ ਵੀ ਕੋਨੇ 'ਤੇ ਉੱਥੇ ਇੱਕ ਪੰਜਾਬੀ ਬੰਦਾ ਇੱਕ ਬੜੇ ਖੇਤਰ ਦੇ ਚੀਜ਼ ਨੂੰ ਮੈਨੇਜ ਕਰਦਾ ਹੋਇਆ ਜ਼ਰੂਰ ਮਿਲੇਗਾ ਜੇ ਆਪਾਂ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਜਿਹੜੀ ਸਾਡੀ ਜਿਹੜੀ ਪੰਜਾਬੀ ਹੈ ਜਿਹੜੇ ਜਿਹੜੇ ਸਾਡੇ ਪੁਰਾਣੇ ਲੋਕ ਹਨ ਉਹ ਤਾਂ ਆਪਣੇ ਕੱਪੜੇ ਦਾ ਜਿਹੜਾ ਪੁਰਾਣਾ ਰੁਝਾਨ ਹੈ ਉਸ ਤੇ ਹੀ ਕੰਮ ਕਰ ਰਹੇ ਹਨ ਜਿਵੇਂ ਕਿ ਉਹ ਕੁੜਤਾ ਪਾਉਂਦੇ ਸੀ ਉਸ ਤੋਂ ਇਲਾਵਾ ਉਹ ਆਪਣੀ ਲੂੰਗੀ ਪਾਂਦੇ ਸੀ ਅਤੇ ਅੱਜਕੱਲ ਦੀ ਜੇ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਅੱਜਕੱਲ ਦੇ ਮੁੰਡੇ ਹੈ ਉਹ ਜ਼ਿਆਦਾਤਰ ਜਿਹੜੇ ਵੈਸਟਰਨ ਕਲਚਰ ਦੇ ਜਿਹੜੇ ਕੱਪੜੇ ਹੈ ਉਹਨਾਂ ਨੂੰ ਪਾਉਣਾ ਪਸੰਦ ਕਰਦੇ ਹਨ ਤਾਂ ਇਸ ਤਰੀਕੇ ਨਾਲ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਹੌਲੀ ਹੌਲੀ ਬਦਲਦਾ ਜਾ ਰਿਹਾ